ਘਰ 'ਚ ਖਾਣਾ ਪਕਾਉਣ ਲਈ ਐਲ ਪੀ ਜੀ ਸਿਲੰਡਰ ਦੀ ਵਰਤੋਂ ਕਰਦੇ ਸਮੇਂ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਵੇਂ ਕਿ ਰੈਗੂਲੇਟਰ ਖਰਾਬ ਹੋਣਾ ਪਾਈਪ ਲੀਕ ਹੋਣਾ ਜਾਂ ਚੁੱਲ੍ਹੇ ਦੇ ਵਿੱਚ ਕੋਈ ਖਰਾਬੀ ਆ ਜਾਣੀ ਬਟਨ ਢਿੱਲੇ ਹੋ ਜਾਣੇ ਸਵਿੱਚ ਖਰਾਬ ਹੋ ਜਾਣੇ ਉਹ ਆਪਾਂ ਨੂੰ ਸਾਵਧਾਨੀਆਂ ਆਪਦੀਆਂ ਵਰਤਣੀਆਂ ਚਾਹੀਦੀਆਂ ਗੌਰ ਕਰਨੀ ਚਾਹੀਦੀ ਹੈ ਇਸ ਚੀਜ਼ ਉੱਤੇ ਜੇਕਰ ਰਸੋਈ ਬੰਦ ਹੈ ਤਾਂ ਉਸ ਨੂੰ ਖੋਲ੍ਹ ਦੇਣਾ ਚਾਹੀਦਾ ਤੁਰੰਤ ਖੋਲ੍ਹ ਦੇਣਾ ਚਾਹੀਦਾ ਹੈ ਮਤਲਬ ਜੇ ਬਲਾਸਟ ਹੁੰਦਾ ਤਾਂ ਆ ਆਟੋਮੈਟਿਕ ਫੁਰਤੀ ਸਮੇਂ ਵਰਤੋਂ ਅਤੇ ਜੇ ਇਕਦਮ ਰਸੋਈ ਦੇ ਵਿੱਚੋਂ ਬਾਹਰ ਨਿਕਲ ਜਾਵੋ ਕਿਉਂਕਿ ਤੁਹਾਡੇ ਜਾਨ 'ਤੇ ਕੋਈ ਖਤਰਾ ਨਾ ਹੋਵੇ ਜੇਕਰ ਫਿਰ ਵੀ ਖਤਰਾ ਹੁੰਦਾ ਤਾਂ ਸਲੰਡਰ ਉੱਪਰ ਗਰਮ ਕੰਬਲ ਸੁੱਟੋ ਤਾਂ ਕਿ ਤਾਂ ਕਿ ਬਲਾਸਟ ਹੋਣ ਤੋਂ ਤੁਹਾਡਾ ਬਚਾਅ ਹੋ ਸਕੇ